ਹੈਲੋ ਹਾਂਜੀ ਭਾਅ ਜੀ ਪੀਜ਼ਾ ਹਟ ਤੋਂ ਬੋਲਦੇ ਪਏ ਭਾਅ ਜੇ ਭਾਅ ਜੀ ਮੈਂ ਨਾ ਦੋ ਬਿੱਗ ਪੀਜ਼ੇ ਔਡਰ ਕੀਤੇ ਸੀ ਤਾਂ ਉਹ ਐਕਚੁਲੀ ਨਾ ਸਾਨੂੰ ਕਿਤੇ ਜਾਣਾ ਪੈ ਰਿਹਾ ਹੈ ਅਤੇ ਉਹ ਕੈਂਸਲ ਕਰਨੇ ਪੈ ਰਹੇ ਨੇ ਅਤੇ ਸਾਡੇ ਕੈਂਸਲ ਹੋ ਸਕਦੇ ਨੇ ਹਾਂਜੀ ਹਾਂਜੀ ਹਾਂਜੀ ਐਕਚੁਲੀ ਪਹਿਲੇ ਸਾਨੂੰ ਪਤਾ ਨੀ ਸੀ ਭਾਅ ਜੀ ਜੇ ਪਤਾ ਹੁੰਦਾ ਤਾਂ ਅਸੀਂ ਕਦੀ ਔਡਰ ਕਰਦੇ ਨਾ ਹਾਂਜੀ ਤੁਹਾਨੂੰ ਵੀ ਪਤਾ ਕਿ ਅਸੀਂ ਪੇਮੈਂਟ ਦੇ ਚੁੱਕੀ ਹਾਂ ਮੈਂ ਇਹਦੀ ਸਾਰੀ ਦੋ ਬਿੱਗ ਪੀਜ਼ੇ ਦੀ ਪੇਮੈਂਟ ਮੈਂ ਤੁਹਾਨੂੰ ਦੇਖੋ ਤੁਸੀਂ ਮੈਂ ਬਿਲ ਦੇਖੋ ਮੈਂ ਪੇਅ ਕਰ ਚੁੱਕੀ ਹਾਂ ਤੁਹਾਨੂੰ ਹਾਂਜੀ ਹਾਂਜੀ

ਹਾਂਜੀ ਭਾਅ ਜੀ ਮੈਂ ਇਸ ਲਈ ਤੁਹਾਨੂੰ ਇਨਫੋਰਮ ਕਰ ਰਹੀ ਹਾਂ ਕਿਉਂਕਿ ਤੁਹਾਡਾ ਦੇਖੋ ਡਿਲੀਵਰੀ ਬੋਆਏ ਆਏਗਾ ਅਤੇ ਇੱਧਰ ਉੱਧਰ ਭਟਕਦਾ ਰਹੇਗਾ ਦੇਖੋ ਇਹ ਕੰਮ ਚੰਗਾ ਨਹੀਂ ਲੱਗਦਾ ਇਸ ਲਈ ਨਾ ਮੈਂ ਤੁਹਾਨੂੰ ਪਹਿਲਾਂ ਹੀ ਇਨਫੋਰਮ ਰਹੀ ਹਾਂ ਕਿ ਪਲੀਜ ਤੁਸੀਂ ਨਾ ਮੇਰਾ ਜੋ ਔਡਰ ਹੈ ਆ ਉਹਨੂੰ ਤੁਸੀਂ ਕੈਂਸਲ ਕਰ ਦਵੋ ਹਾਂ ਅਗਰ ਤੁਸੀਂ ਹਾਂਜੀ ਹਾਂਜੀ ਬੇਸ਼ੱਕ ਤੁਸੀਂ ਜੋ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਪੈਸੇ ਕੱਟਣੇ ਨੇ ਤਾਂ ਤੁਸੀਂ ਕੱਟ ਕੇ ਬਾਕੀ ਤੁਸੀਂ ਮੈਨੂੰ ਡੈਬਿਟ ਕਰ ਦਵੋ ਹਾਂਜੀ ਹਾਂਜੀ ਭਾਅ ਜੀ ਮੈਂ ਔਡਰ ਕੀਤਾ ਸੀ ਨਿਰ ਨਿਰੰਕਾਰੀ ਕਾਲੋਨੀ ਫਤਿਹਗੜ੍ਹ ਚੂੜੀਆਂ ਰੋਡ ਹਾਊਸ ਨੰਬਰ ਥਰਟੀ ਮਾਨ ਨਿਵਾਸ ਹਾਂਜੀ ਜੀ ਹਾਂਜੀ ਹਾਂਜੀ ਭਾਅ ਜੀ ਦੇਖ ਕੇ ਮੈਨੂੰ ਦੱਸੋ ਜਰਾ ਪਲੀਜ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਜੀ ਜੇ ਉਹ ਕੈਂਸਲ ਹੋ ਸਕਦਾ ਤਾਂ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਕਿਉਂਕਿ ਸਾਡੇ ਤਾਂ ਮਗਰੋਂ ਕੋਈ ਖਾਣ ਰਿਸੀਵ ਕਰਨ ਵਾਲਾ ਹੀ ਨਹੀਂ ਹੈਗਾ ਦੇਖੋ ਕੋਈ ਹੁੰਦਾ ਤਾਂ ਮੈਂ ਕੈਂਸਲ ਨਹੀਂ ਕਰਨਾ ਮੈਨੂੰ ਵੀ ਦੁੱਖ ਹੋ ਰਿਹਾ ਹੈ ਕਿ ਦੇਖੋ ਅਸੀਂ ਔਡਰ ਕਰਕੇ ਤੁਹਾਡਾ ਕੈਂਸਲ ਕਰ ਰਹੀ ਹਾਂ ਮੈਂ

ਠੀਕ ਹੈ ਜੀ ਠੀਕ ਹੈ ਥੈਂਕ ਯੂ ਵੈਰੀ ਮੱਚ